ਪੰਜਾਬ ਪੰਜਾਬੀ ਸੱਭਿਆਚਾਰ ਦੀ ਝਲਕ ਅੱਜ ਪੂਰੀ ਦੁਨੀਆਂ 'ਚ ਦੇਖਣ ਨੂੰ ਮਿਲਦੀ ਆ ਜਿੱਥੇ ਜਿੱਥੇ ਪੰਜਾਬੀ ਵਸੇ ਹੋਏ ਨੇ ਪੰਜਾਬ ਦੇ ਵਿੱਚ ਕੁਝ ਪਰੰਪਰਾਗਤ ਤਿਉਹਾਰ ਮਨਾਏ ਜਾਂਦੇ ਆ ਜਿਵੇਂ ਲੋਹੜੀ ਲੋਹੜੀ ਵੈਸੇ ਇਹ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਹੈ ਪਰ ਅੱਜ ਕੱਲ੍ਹ ਲੋਕਾਂ ਦਾ ਨਜ਼ਰੀਆ ਬਦਲ ਗਿਆ ਲੋਕ ਪੜ੍ਹੇ ਲਿਖੇ ਹੋ ਕੇ ਕੁੜੀਆਂ ਦੀ ਲੋਹੜੀ ਮਨਾਈ ਜਾਂਦੀ ਆ ਪੰਜਾਬ ਦੇ ਵਿੱਚ ਦੀਪਾਵਲੀ ਮਨਾਈ ਜਾਂਦੀ ਹੈ ਬੜੇ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਕਿਉਂਕਿ ਇਹਨੂੰ ਇੱਕ ਧਾਰਮਿਕ ਨਜ਼ਰੀਏ ਨਾਲ ਵੀ ਦੇਖਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਗੁਰੂ ਸੋਰੀ ਹਰਗੋਬਿੰਦ ਸਿੰਘ ਜੀ ਛੇਵੇਂ ਪਾਤਸ਼ਾਹ ਜਹਾਂਗੀਰ ਦੀ ਕੈਦ ਚੋਂ ਬਵੰਜੀ ਬਵੰਜਾ ਰਾਜਿਆਂ ਨੂੰ ਨਾਲ ਲੈ ਕੇ ਆਏ ਸੀ ਉਹਨਾਂ ਨੂੰ ਛੁਡਵਾਇਆ ਸੀ ਕੈਦ ਤੋਂ ਉਹਨਾਂ ਦੀ ਖੁਸ਼ੀ ਦੇ ਵਿੱਚ ਪੰਜਾਬ ਦੇ ਲੋਕ ਸਿੱਖ ਪਰਿਵਾਰ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਰਾਮ ਚੰਦਰ ਜੀ ਦੇ ਨਾਲ ਸੰਬੰਧਿਤ ਹੈ ਦਿਵਾਲੀ ਦਾ ਤਿਉਹਾਰ ਦਿਵਾਲੀ ਲੋਹੜੀ ਅਤੇ ਬਸੰਤ ਬਸੰਤ ਤੋਂ ਬਾਖੂਬ ਹੈ ਪੰਜਾਬ 'ਚ ਮਾਲਵੇ ਖੇਤਰ ਦੇ ਵਿੱਚ ਬਸੰਤ ਮਨਾਈ ਜਾਂਦੀ ਹੈ ਬਸੰਤ ਪੰਚਮੀ 'ਤੇ ਅਤੇ ਮਾਝੇ ਦੇ ਖੇਤਰ ਦੇ ਵਿੱਚ ਅੰਮ੍ਰਿਤਸਰ ਇਲਾਕਾ ਹੈ ਉੱਥੇ ਬਸੰਤ ਮਨਾਈ ਜਾਂਦੀ ਹੈ ਨਵੇਂ ਸਾਲ 'ਤੇ ਨਵੇਂ ਸਾਲ 'ਤੇ ਛੱਬੀ ਜਨਵਰੀ ਨੂੰ ਉੱਥੇ ਲੋਕ ਬਸੰਤ ਮਨਾਉਂਦੇ ਨੇ ਥੋੜ੍ਹਾ ਅਲੱਗ ਅਲੱਗ ਹੈ ਖੇਤਰ ਦੇ ਹਿਸਾਬ ਦੇ ਨਾਲ ਪਰ ਪੰਜਾਬ ਦੇ ਵਿੱਚ ਬਸੰਤ ਦਾ ਤਿਉਹਾਰ ਬਹੁਤ ਖੂਬ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਜਿਹਦੇ ਪਰਿਵਾਰ 'ਚ ਲੋਹੜੀ ਹੁੰਦੀ ਹੈ ਤਾਂ ਲੋਕ ਗਲੀ ਮੁਹੱਲੇ ਨਗਰ ਦੇ ਵਿੱਚ ਲੋਹੜੀ ਵੰਡਦੇ ਨੇ ਬੱਚੇ ਦੀ ਔਰ ਸਾਰਾ ਪਰਿਵਾਰ ਰਾਤ ਨੂੰ ਬਹਿ ਕੇ ਗਲੀ ਗੁਆਂਢ ਤੇ ਬਹਿ ਕੇ ਲੋਕ ਲੋਹੜੀ ਤੇ ਬਹਿੰਦੇ ਨੇ ਔਰ ਆਪਣੀਆਂ ਗੱਲਾਂ ਕਰਦੇ ਨੇ ਧਾਰਮਿਕ ਗੀਤ ਗਾਉਂਦੇ ਨੇ ਕਿਉਂਕਿ ਤਿਉਹਾਰ ਇਹ ਚੀਜ਼ ਆ ਜਿਹੜੀ ਲੋਕਾਂ ਨੂੰ ਇਕੱਠਾ ਕਰਕੇ ਰੱਖਦੀ ਹੈ ਅਸੀਂ ਡਿਜੀਟਾਈਜੇਸ਼ਨ ਦੇ ਦੌਰ ਦੇ ਵਿੱਚ ਮੋਬਾਈਲ ਦੇ ਦੌਰ ਦੇ ਵਿੱਚ ਹਰ ਬੰਦਾ ਇਕੱਲਾ ਹੋ ਗਿਆ ਹਰ ਕੋਲ ਆਪਣੀ ਐਲ ਈ ਡੀ ਹੈ ਫੋਨ ਹੈ ਆਈਫੋਨ ਹੈ ਇਸ ਕਰਕੇ ਤਿਉਹਾਰਾਂ ਦਾ ਬਹੁਤ ਵੱਡਾ ਰੋਲ ਹੈ ਵੀ ਸਭ ਨੂੰ ਇਕੱਠਾ ਕਰਕੇ ਰੱਖਦੇ ਨੇ ਪੰਜਾਬ ਦਾ ਤਿਉਹਾਰ ਤੋ ਵੱਖਰਾ ਹੀ ਹੈ ਜਿੱਥੇ ਵੀ ਪੂਰੇ ਹਿੰਦੁਸਤਾਨ 'ਚ ਕਿਤੇ ਵੀ ਚੱਲ ਜਾਓ ਨੌਰਥ ਇੰਡੀਆ ਦੇ ਵਿੱਚ ਪੰਜਾਬ ਇੱਕ ਵੱਖਰਾ ਸਟੇਟ ਹੈ ਇੱਕ ਵੱਖਰੀ ਪਹਿਚਾਣ ਰੱਖਦਾ ਇਹਦਾ ਸੱਭਿਆਚਾਰ ਜੋ ਵੀ ਇੱਥੇ ਕਦੇ ਸੈਲਾਨੀ ਆਉਂਦੇ ਨੇ ਉਹ ਜੇ ਉਹ ਤਿਉਹਾਰ ਦੇ ਸਮੇਂ 'ਤੇ ਇੱਥੇ ਹੋਣ ਤਾਂ ਦੋ ਚਾਰ ਦਿਨ ਤਿਉਹਾਰ ਦੇਖਣ ਲਈ ਜ਼ਰੂਰ ਰੁਕਦੇ ਨੇ ਪੰਜਾਬ ਦੇ ਸ ਕਲਚਰ ਨੂੰ ਪੰਜਾਬ ਦੇ ਤਿਉਹਾਰ ਦੀਆਂ ਯਾਦਾਂ ਨੂੰ ਆਪਣੇ ਅੰਗ ਸੰਗ ਲੈ ਕੇ ਜਾਂਦੇ ਨੇ